ਮੋਹਾਲੀ ਜ਼ਿਲ੍ਹੇ ਵਿੱਚ ਕਈ ਮਹੱਤਵਪੂਰਨ ਸਥਾਨ ਨੇ ਸਥਾਨ ਹਨ ਜਿਹਨਾਂ ਵਿੱਚੋਂ ਸੋਹਾਣਾ ਗੁਰਦੁਆਰਾ ਸਾਹਿਬ ਏਅਰਪੋਰਟ ਚੱਪੜਚਿੜੀ ਗੁਰਦੁਆਰਾ ਸਾਹਿਬ ਮੋਲ ਸੋਹਾਣਾ ਗੁਰਦੁਆਰਾ ਸਾਹਿਬ ਪਹਿਲਾਂ ਬਹੁਤ ਛੋਟਾ ਹੁੰਦਾ ਸੀ ਅੱਜ ਕੱਲ੍ਹ ਇਸ ਦੀ ਬਹੁਤ ਜ਼ਿਆਦਾ ਮਹੱਤਤਾ ਹੋਈ ਹੋਈ ਹੈ ਜਿਸ ਕਰਕੇ ਬਹੁਤ ਦੂਰੋਂ ਲੋਕ ਆਉਂਦੇ ਹਨ ਇੱਥੇ ਅਤੇ ਲੋਕਾਂ ਦੀਆਂ ਮੰਨਤਾਂ ਵੀ ਪੂਰੀਆਂ ਹੁੰਦੀਆਂ ਹਨ ਜਿਹੜੇ ਇੱਥੇ ਮੋਲ ਬਣੇ ਹਨ ਇੱਥੇ ਮੋਲ ਬਹੁਤ ਵੱਡੇ ਵੱਡੇ ਹਨ ਮੋਹਾਲੀ 'ਚ ਜਿਹਨਾਂ ਵਿੱਚ ਬਹੁਤ ਵੱਡੇ ਵੱਡੇ ਸਿਨੇਮਾ ਥਿਏਟਰ ਹਨ ਜਿੱਥੇ ਪਿਕਚਰਾਂ ਦਿਖਾਈਆਂ ਜਾਂਦੀਆਂ ਹਨ ਅਤੇ ਇੱਥੇ ਬਹੁਤ ਬੜੀ ਕ ਕੰਪਨੀਆਂ ਦੇ ਦੁਕਾਨਾਂ ਹਨ ਜਿੱਥੇ ਸੋਜ਼ ਕੱਪੜੇ ਆਦਿ ਬਹੁਤ ਤਰ੍ਹਾਂ ਦੇ ਮਿਲਦੇ ਹਨ ਇਹਨਾਂ ਵਿੱਚੋਂ ਬਹੁਤ ਤਰ੍ਹਾਂ ਦੀ ਸਕੀਮਾਂ ਵੀ ਲਗਾਈਆਂ ਜਾਂਦੀਆਂ ਹਨ ਜਿਨ੍ਹਾਂ ਕਰਕੇ ਰੇਟ ਵੀ ਘੱਟ ਹੋ ਜਾਂਦੇ ਹਨ ਘੱਟ ਰੇਟਾਂ ਕਰਕੇ ਇੱਥੇ ਦੇ ਸਮਾਨ ਬਹੁਤ ਜ਼ਿਆਦਾ ਵਿਕਦਾ ਹੈ ਅਤੇ ਬਾਹਰੋਂ ਲੋਕ ਬਹੁਤ ਬਹੁਤ ਸਮਾਨ ਖਰੀਦਣ ਆਉਂਦੇ ਹਨ